ਮੇਰਾ ਨਾਮ ਸਮਰੀਤੀ ਮੈਂ ਵੀਹ ਕੁ ਦਿਨ ਪਹਿਲਾਂ ਆਪਣੇ ਵਾਸਤੇ ਇੱਕ ਫੋਨ ਔਡਰ ਕੀਤਾ ਸੀ ਉਹ ਫੋਨ ਮੈਂ ਆਪਣੇ ਵਾਸਤੇ ਨਹੀਂ ਮੈਂ ਆਪਣੀ ਮੰਮੀ ਨੂੰ ਗਿਫਟ ਕਰਨ ਲਈ ਖਰੀਦਿਆ ਸੀ ਉਸ ਫੋਨ ਤੋਂ ਮੈਨੂੰ ਕਾਫੀ ਸਾਰੀਆਂ ਉਮੀਦਾਂ ਸਨ ਅਤੇ ਉਹ ਮੈਨੂੰ ਪਾਰਸਲ ਕੱਲ੍ਹ ਰਿਸੀਵ ਹੋਇਆ ਅਤੇ ਉਹਦੇ ਨਾਲ ਦਾ ਹੀ ਫੋਨ ਮੈਂ ਪਹਿਲਾਂ ਆਪਣੇ ਲਈ ਔਡਰ ਕੀਤਾ ਸੀ ਉਹ ਫੋਨ ਬਹੁਤ ਹੀ ਵਧੀਆ ਉਹਦੇ ਵਿੱਚ ਮੈਨੂੰ ਪ੍ਰੋਪਰ ਸਾਰਾ ਚਾਰਜਰ ਅਡੈਪਟਰ ਸਾਰਾ ਕੁਛ ਮਿਲਿਆ ਹੋਇਆ ਏ ਜਿਸ ਦੇ ਸਾਰੇ ਹੀ ਫੰਕਸ਼ਨ ਬਹੁਤ ਜ਼ਿਆਦਾ ਵਧੀਆ ਹਨ ਉਹਦੀ ਸਕਰੀਨ ਵੀ ਬਹੁਤ ਵਧੀਆ ਸਕਰੀਨ ਸਾਈਜ਼ ਵੀ ਬਹੁਤ ਵਧੀਆ ਉਹ ਹਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਮੈਨੂੰ ਹਜੇ ਤੱਕ ਉਸ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਮੈਨੂੰ ਤਿੰਨ ਮਹੀਨੇ ਉਸ ਫੋਨ ਨੂੰ ਵਰਤਦੇ ਹੋਏ ਹੋ ਗਏ ਅਤੇ ਇਸ ਉਮੀਦ ਨਾਲ ਮੈਂ ਇਹ ਫੋਨ ਆਪਣੀ ਮੰਮੀ ਨੂੰ ਗਿਫਟ ਕਰਨ ਵਾਸਤੇ ਖਰੀਦਿਆ ਸੀ ਅਤੇ ਮੈਨੂੰ ਉਹੀ ਉਮੀਦ ਸੀ ਕਿ ਜਿਵੇਂ ਮੇਰਾ ਫੋਨ ਸੀ ਉੱਦਾਂ ਹੀ ਮੇਰੀ ਮੰਮੀ ਵਾਸਤੇ ਆਵੇਗਾ ਬਟ ਕੱਲ੍ਹ ਜਦ ਮੈਨੂੰ ਵੀਹ ਦਿਨ ਬਾਅਦ ਪਾਰਸਲ ਰਿਸੀਵ ਹੋਇਆ ਪਾਰਸਲ ਦੀ ਕੰਡੀਸ਼ਨ ਬਹੁਤ ਬੇਕਾਰ ਸੀ ਅਤੇ ਜਦੋਂ ਮੈਂ ਪਾਰਸਲ ਖੋਲ੍ਹਿਆ ਅਤੇ ਖੋਲ੍ਹਣ ਤੋਂ ਬਾਅਦ ਦੇਖਿਆ ਉਹਦੀ ਸੀਲ ਟੁੱਟੀ ਹੋਈ ਸੀ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਸੀਲ ਜਦੋਂ ਮੈਂ ਖੋਲ੍ਹੀ ਅਤੇ ਉਹਦੇ ਵਿੱਚ ਫੋਨ ਹੈਗਾ ਤਾਂ ਸੀ ਅਤੇ ਫੋਨ ਪਹਿਲਾਂ ਤੋਂ ਹੀ ਸਟਾਰਟ ਕੀਤਾ ਹੋਇਆ ਸੀ ਅਤੇ ਜਦੋਂ ਫੋਨ ਚਲਾਇਆ ਨਾ ਉਸ ਦਾ ਕੋਈ ਫੀਚਰ ਚੱਜ ਨਾਲ਼ ਕੰਮ ਕਰ ਰਿਹਾ ਸੀ ਨਾ ਉਹਦੇ ਵਿੱਚ ਚਾਰਜਰ ਸੀ ਅਤੇ ਉਹਦੀ ਸਕਰੀਨ ਵੀ ਹੈਂਗ ਹੋ ਹੋ ਕੇ ਚੱਲ ਰਹੀ ਸੀ ਉਹ ਫੋਨ ਵਧੀਆ ਕੰਡੀਸ਼ਨ ਵਿੱਚ ਨਹੀਂ ਸੀ ਜਿੱਦਾਂ ਮੈਨੂੰ ਮੇਰਾ ਲੱਗਿਆ ਸੀ ਮੇਰਾ ਫੋਨ ਆਇਆ ਉਹ ਵੀ ਆਵੇਗਾ ਉਹ ਫੋਨ ਉੱਦਾਂ ਨਹੀਂ ਤਾ ਉਹ ਕਾਫੀ ਜ਼ਿਆਦਾ ਬੁਰੀ ਹਾਲਤ ਵਿੱਚ ਸੀ ਅਤੇ ਉਸ ਫੋਨ ਦੇ ਵਿੱਚ ਨਾ ਉਹਦਾ ਕੋਈ ਫੀਚਰ ਚੱਜ ਨਾਲ਼ ਕੰਮ ਕਰ ਰਿਹਾ ਸੀ ਅਤੇ ਉਹ ਦੇਖ ਕੇ ਸਾਨੂੰ ਬਹੁਤ ਬੁਰਾ ਲੱਗਿਆ ਉਹ ਫੋਨ ਤੋਂ ਕ ਉਹ ਮੈਂ ਆਪਣੀ ਮੰਮੀ ਨੂੰ ਗਿਫਟ ਕਰਨਾ ਸੀ ਜਿਸ ਕਰ ਕੇ ਮੈਂ ਉਹ ਵੀ ਨਹੀਂ ਕਰ ਪਾਈ ਅਤੇ ਜਦੋਂ ਮੈਂ ਫੋ ਅ ਪਾਰਸਲ ਰਿਟਰਨ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਰਿਟਰਨ ਕਰਨ ਤੋਂ ਹੀ ਮਨਾ ਕਰ ਦਿੱਤਾ ਅਤੇ ਹੁਣ ਉਹ ਫੋਨ ਮੇਰੇ ਕੋਲ ਇਵੇਂ ਹੀ ਪਿਆ ਏ ਨਾ ਉਸ ਦੀ ਕੋਈ ਮਤਲਬ ਯੂਜ਼ ਹੈ ਉਹ ਫੋਨ 'ਤੇ ਮੈਂ ਕਾਫੀ ਸਾਰੇ ਪੈਸੇ ਵੀ ਲਾਏ ਸੀ ਫੋਨ ਕਾਫੀ ਮਹਿੰਗਾ ਸੀ ਇੰਨਾਂ ਪੈਸੇ ਦੇਣ ਤੋਂ ਬਾਅਦ ਵੀ ਉਹ ਫੋਨ ਇੰਨਾਂ ਘਟੀਆ ਆਇਆ ਹੈ ਅਤੇ ਇਸ ਗੱਲ ਦੀ ਉਮੀਦ ਨਹੀਂ ਸੀ ਅਤੇ ਫੋਨ ਨਾ ਕੁਛ ਉਹਦਾ ਚੱਜ ਨਾਲ ਕੰਮ ਕਰ ਰਿਹਾ ਨਾ ਉਹ ਅੱਗੇ ਕਰੇਗਾ ਨਾ ਉਹਦਾ ਕੋਈ ਯੂਜ਼ ਹੈ ਹੁਣ ਘਰ ਵਿੱਚ ਇੱਦਾਂ ਈ ਪਿਆ ਹੈ